ਮੈਂ ਰਿਲਾਇੰਸ ਮੋਲ ਤੋਂ ਕਰੋਕਰੀ ਖਰੀਦੀ ਸੀ ਅਤੇ ਮੇਰਾ ਉਸ ਨਾਲ ਅਨੁਭਵ ਬਹੁਤ ਵਧੀਆ ਗਿਆ ਉਹਨਾਂ ਦੀ ਕਰੋਕਰੀ ਬਹੁਤ ਜ਼ਿਆਦਾ ਵਧੀਆ ਸੀ ਕੰਚ ਦੇ ਮਟੀ ਕੰਚ ਦੇ ਸਮਾਨ ਦੀ ਬਣੀ ਹੋਈ ਸੀ ਅਤੇ ਉਸਦਾ ਮਾਲ ਵੀ ਬਹੁਤ ਜ਼ਿਆਦਾ ਮਜਬੂਤ ਸੀ ਮੈਂ ਉਸ ਨੂੰ ਬਹੁਤੀ ਵਾਰ ਭੋਜਨ ਦੇਣ ਵੇਲੇ ਇਸਤੇਮਾਲ ਕਰ ਸਕਦੀ ਹਾਂ ਜਦੋਂ ਘਰ ਮਹਿਮਾਨ ਆਏ ਅਤੇ ਉਹਦਾ ਟੁੱਟਣ ਦਾ ਵੀ ਕੋਈ ਡਰ ਨਹੀਂ ਹੈ